ਜਿਵੇਂ ਕਿ ਪਿੰਡ ਦੇ ਨੌਜਵਾਨ ਵੱਖ ਵੱਖ ਡਾਂਸ ਫਾਰਮਾਂ ਨਾਲ ਜੁੜਨ ਲਈ ਉਹ ਅਕੈਡਮੀਆਂ ਨੂੰ ਜੁਆਇਨ ਕਰਦੇ ਹਨ ਅਤੇ ਡਾਂਸ ਕਲਾਸਿਸ ਜੁਆਇਨ ਕਰਦੇ ਹਨ ਅਤੇ ਉੱਥੇ ਜਾ ਕੇ ਹਰੇਕ ਧਰਮ ਦਾ ਅਤੇ ਕਲਚਰ ਦਾ ਡਾਂਸ ਸਿੱਖਣਾ ਪਸੰਦ ਕਰਦੇ ਹਨ ਅਤੇ ਹਰ ਕਲਚਰ ਦਾ ਡਾਂਸ ਸਿੱਖ ਕੇ ਉਹ ਵਧੀਆ ਤਰੀਕੇ ਨਾਲ ਹੋਰ ਲੋਕਾਂ ਨੂੰ ਵੀ ਉਸ ਨਾਲ ਜੋੜਦੇ ਹਨ ਅਤੇ ਆਪਣੇ ਉਤਸ਼ਾਹ ਆਪਣੇ ਆਪਣੇ ਸ਼ੌਕ ਲਈ ਉਹ ਡਾਂਸ ਅਕੈਡਮੀ ਡਾਂਸ ਕਲਾਸਿਜ਼ ਜਿੱਥੇ ਵੀ ਉਹਨਾਂ ਨੂੰ ਡਾਂਸ ਦੀ ਅਕੈਡਮੀ ਅਤੇ ਕਲਾਸਿਜ਼ ਮਿਲੇ ਉਹ ਉੱਥੇ ਜਾ ਕੇ ਉਹਨਾਂ ਨੂੰ ਜੁਆਇਨ ਕਰਦੇ ਹਨ ਅਤੇ ਹਰ ਇੱਕ ਹਰ ਇੱਕ ਡਾਂਸ ਫੋਮ ਨੂੰ ਸਿੱਖਦੇ ਹਨ ਉਹਨਾਂ ਨੂੰ ਸਿੱਖ ਕੇ ਫਿਰ ਉਹ ਅੱਗੇ ਲੋਕਾਂ ਨੂੰ ਵੀ ਉਸ ਨਾਲ ਜੋੜਦੇ ਹਨ ਅਤੇ ਉਹਨਾਂ ਨੂੰ ਵੀ ਉਹਨਾਂ ਬਾਰੇ ਜਾਗਰੂਕ ਕਰਦੇ ਹਨ ਅਤੇ ਉਹਨਾਂ ਨੂੰ ਜਾਣਕਾਰੀ ਦਿੰਦੇ ਹਨ ਕਿ ਡਾਂਸ ਅਕੈਡਮੀਆਂ ਨਾਲ ਜੁੜ ਕੇ ਅਤੇ ਉਨ੍ਹਾਂ ਨਾਲ਼ ਉੱਥੇ ਜਾ ਕੇ ਤੁਸੀਂ ਡਾਂਸ ਫਾਰਮ ਸਿੱਖ ਸਕਦੇ ਹੋ ਅਤੇ ਹਰ ਇੱਕ ਕਲਚਰ ਦਾ ਡਾਂਸ ਸਿੱਖ ਸਕਦੇ ਹੋ ਅਤੇ ਤੁਸੀਂ ਹਰ ਇੱਕ ਡਾਂਸ ਫੋਰਮ ਨਾਲ ਜੁੜ ਸਕਦੇ ਹੋ